ਇੱਕੀ ਫਰਵਰੀ ਉੱਨੀ ਸੌ ਇਕਾਨਵੇਂ ਬਾਈ ਅਪ੍ਰੈਲ ਉੱਨੀ ਸੌ ਨੱਬੇ ਉਨੱਤੀ ਸਤੰਬਰ ਉੱਨੀ ਸੌ ਬਾਨਵੇਂ ਤੇਈ ਨਵੰਬਰ ਉੱਨੀ ਸੌ ਪਚਾਨਵੇਂ ਛੱਬੀ ਜੁਲਾਈ ਉੱਨੀ ਸੌ ਨੜਿੱਨਵੇਂ